ਜੀ ਹਾਂ ਕੁਝ ਖੇਡਾਂ ਹੁੰਦੀਆਂ ਹਨ ਜੋ ਮੇਰੇ ਮਨ ਨੂੰ ਕਾਫੀ ਖਾਸ ਤੌਰ 'ਤੇ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਜਾ ਅਰਥ ਪੂਰਨ ਮਹਿਸੂਸ ਕਰਵਾ ਕਰਵਾਈ ਹੈ ਜਿਵੇਂ ਕਿ ਕ੍ਰਿਕਟ ਇੱਕ ਖੇਡ ਹੈ ਜੋ ਬਹੁਤ ਸਾਰੇ ਲੋਕਾਂ ਲਈ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਇਹ ਉਹਨਾਂ ਦੀ ਜੀਵਨ ਸ਼ੈਲੀ ਨੂੰ ਸਪੋਰਟ ਅਤੇ ਆਨੰਦ ਪ੍ਰਦਾਨ ਕਰਦਾ ਹੈ ਵਿਰੋਧੀ ਟੀਮ ਨੂੰ ਹਰਾਉਣ ਵਾਲੇ ਮੌਕੇ ਅਤੇ ਉਤਸਾਹਿਤ ਹੋਣ ਵਾਲੇ ਮੰਨੇ ਜਾਂਦੇ ਹਨ ਜੋ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਹੁੰਦੇ ਹਨ ਕ੍ਰਿਕਟ ਇੱਕ ਖੇਡ ਹੈ ਜੋ ਨਾ ਸਿਰਫ ਖੇਡਾਂ ਦੇ ਮੈਦਾਨ 'ਤੇ ਬਲਕਿ ਔਰਨਾਤਕ ਤੌਰ 'ਤੇ ਲੋਕਾਂ ਦੇ ਦਿਲਾਂ 'ਤੇ ਵੀ ਕਾਬੂ ਪਾਉਂਦਾ ਹੈ ਇਹ ਖੇਡ ਕਿਸੇ ਵੀ ਯੁੱਗ ਦੇ ਲੋਕਾਂ ਨੂੰ ਜੋੜਨ ਦਾ ਸਾਧਨ ਬਣਦਾ ਹੈ ਅਤੇ ਉਹਨਾਂ ਦੀ ਭਾਵਨਾਵਾਂ ਨੂੰ ਸਾਂਝਾ ਕਰਦਾ ਹੈ ਇਸ ਵਿੱਚ ਵੀਰਾ ਗੜਾ ਅਤੇ ਉਤਸਾਹ ਹੀ ਨਹੀਂ ਬਲਕਿ ਬਲਕਿ ਸਾਂਝੀ ਜ਼ਿੰਦਗੀ ਅਤੇ ਇਕਰਤਾ ਭਾਵਨਾਵਾਂ ਦੀ ਵੀ ਸ ਸਾਕਾਰ ਕੀਤੀ ਜਾਂਦੀ ਹੈ ਵਿਰੋਧੀ ਟੀਮ ਨੂੰ ਹਰਾਉਣ ਵਾਲੇ ਮੌਕੇ ਅਤੇ ਉਤਸਾਹਿਤ ਹੋਣ ਵਾਲੇ ਸੁਨੇਹੇ ਬੰਨ੍ਹੇ ਜਾਂਦੇ ਹਨ ਜੋ ਭਾਵਨਾਤਮਕ ਤੌਰ 'ਤੇ ਪ੍ਰਭਾਵਸ਼ਾਲੀ ਹੁੰਦੇ ਹਨ ਇਸ ਤਰ੍ਹਾਂ ਕ੍ਰਿਕਟ ਨਹੀਂ ਸਿਰਫ ਖੇਡ ਬਲਕਿ ਇੱਕ ਸੋਚ ਅਤੇ ਭਾਵਨਾਵਾਂ ਦੀ ਮਿਸਾਲ ਹੈ ਜੋ ਸੰਘਰਸ਼ ਅਤੇ ਇਕਤਰਤਾ ਨੂੰ ਪ੍ਰਸ਼ੋ ਨੂੰ ਪ੍ਰਤੋਸ਼ਿਤ ਕਰਦੀ ਹੈ ਕ੍ਰਿਕਟ ਦਾ ਮਹੱਤਵ ਸਿਰਫ ਖੇਡ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਉੱਚ ਸੋਚ ਅਤੇ ਮੁਸ਼ਕਿਲ ਮੋੜਾਂ ਨੇ ਇਸ ਨੂੰ ਇੱਕ ਅਦ ਅਦਭੁਤ ਰੂਪ ਦਿੱਤਾ ਹੈ ਬਹੁਤ ਸਾਰੇ ਉਦਾਹਰਣ ਹਨ ਜਿੱਥੇ ਕ੍ਰਿਕਟ ਦੇ ਮੈਦਾਨ 'ਤੇ ਹੋਏ ਜ਼ਿੰਦਗੀ ਦੇ ਮੋੜਾਂ ਅਤੇ ਮੁਸ਼ਕਲ ਸਮੇਂ ਵਿੱਚ ਵਿਰੋਧੀਆਂ ਦਾ ਸਾਹਮਣਾ ਕਰਦੇ ਹਨ ਇਸ ਤਾਕਤ ਨਾਲ ਦੇ ਉੱਚ ਜ਼ੋਰ ਅਤੇ ਸੰਘਰਸ਼ ਨੂੰ ਦੜਿਤ ਕਰਨ ਵਾਲੇ ਮੂਮੈਂਟਮ ਮੋਮੈਂਟਸ ਕ੍ਰਿਕਟ ਦੀ ਮਹੱਤਤਾ ਨੂੰ ਹੋਰ ਵੀ ਵਾਧਾ ਕਰ ਦਿੰਦੇ ਹਨ ਇਸ ਤਰ੍ਹਾਂ ਕ੍ਰਿਕਟ ਸਿਰਫ ਇੱਕ ਖੇਡ ਨਹੀਂ ਬਲਕਿ ਇੱਕ ਸੋਚ ਅਤੇ ਜੀਵਨ ਦੀ ਸਿਰਜਣਾ ਦਾ ਸਾਜਨ ਹੈ ਜੋ ਸੰਘਰਸ਼ ਅਤੇ ਇੱਕਤਰਤਾ ਨੂੰ ਪ੍ਰੋਸ਼ ਪ੍ਰ ਪ੍ਰਤੋਸ਼ਿਤ ਕਰਤਾ ਹੈ